ਮੈਂ ਜੋ ਰਾਜਸਥਾਨ ਦੇ ਵਿੱਚ ਸਾਹਲਾ ਸਰਥਾਮ ਹੈ ਉੱਥੇ ਗਿਆ ਇਸ ਤੋਂ ਬਿਨਾਂ ਮੈਂ ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਗਿਆ ਇਸ ਤੋਂ ਬਿਨਾਂ ਦੇਵ ਜੋਤੀ ਸਥਾਨ ਆਸ਼ਰਮ ਜੋ ਨੂਰ ਮਹਿਲ ਦੇ ਵਿੱਚ ਹੈ ਉੱਥੇ ਮੈਂ ਗਿਆ ਅਤੇ ਸਭ ਤੋਂ ਵਧੀਆ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਸਥਾਨ ਦੇ ਵਿੱਚ ਉਹ ਨੂਰ ਮਹਿਲ ਹੈ ਵਿਖੇ ਸਥਿਤ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਥੇ ਜਾ ਕੇ ਜੋ ਮੈਨੂੰ ਪਸੰਦ ਆਈ ਕਹਿ ਸਕਦੇ ਜਾਂ ਲੱਗੀ ਕਿ ਸ ਮੈਨੂੰ ਪੂਰਨ ਗੁਰੂ ਬਾਰੇ ਜਾਣਕਾਰੀ ਮਿਲੀ ਅਤੇ ਪੂਰਨ ਗੁਰੂ ਨੇ ਕੀ ਨਿਸ਼ਾਨੀ ਹੈ ਤਾਂ ਉੱਥੇ ਜਿਹੜੇ ਚਾਰ ਪਦਾਰਥਾਂ ਦੇ ਗਿਆਨ ਦੀ ਗੱਲ ਹੈ ਜਿਹੜੀ ਉਹ ਸਮਝ ਆਈ ਤਾਂ ਉਹ ਮੈਨੂੰ ਚਾਰ ਪਦਾਰਥਾਂ ਦੇ ਗਿਆਨ ਨੇ ਹੈਰਾਨ ਕੀਤਾ ਕਿ ਸਾਰੇ ਧਾਰਮਿਕ ਗ੍ਰੰਥ ਹੈ ਜਿਹੜੇ ਉਹਨਾਂ 'ਚ ਇੱਕੋ ਹੀ ਮੂਲ ਹੈ ਕਿ ਤੁਸੀਂ ਪੂਰਨ ਗੁਰੂ ਦੇ ਦਰਬਾਰ ਚ ਜਾਣਾ ਪਰ ਸਾਨੂੰ ਜਿਹੜੇ ਧਾਰਮਿਕ ਆਗੂ ਉਹ ਅੱਡ ਅੱਡ ਵੰਡ ਕੇ ਰੱਖਦੇ ਹੈਗੇ ਹੈ ਕੋਈ ਸਾਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਪੂਰਨ ਗੁਰੂ ਦਾ ਦਰਬਾਰ ਹੈ ਜਿਹੜਾ ਉਹ ਸਾਨੂੰ ਪੂਰਨ ਗੁਰੂ ਬਾਰੇ ਦੱਸਦਾ ਅਤੇ ਪੂਰਨ ਗੁਰੂ ਦੇ ਨਿਸ਼ਾਨੀਆਂ ਦੱਸਦਾ ਕਿ ਉਹ ਜਦੋਂ ਵੀ ਤੁਹਾਨੂੰ ਜ਼ਿੰਦਗੀ 'ਚ ਮਿਲੇਗਾ ਤੁਹਾਡੇ ਮਸਤਕ 'ਤੇ ਹੱਥ ਰੱਖ ਕੇ ਤੁਹਾਡੇ ਮੱਥੇ 'ਤੇ ਹੱਥ ਰੱਖ ਕੇ ਤੁਹਾਨੂੰ ਚਾਰ ਪਦਾਰਥਾਂ ਦੇ ਬਾਰੇ ਗਿਆਨ ਕਰਵਾਏਗਾ ਤਾਂ ਮੈਨੂੰ ਦਿਵਜੋਤੀ ਦੇ ਸਥਾਨ ਦੇ ਆਸ਼ਰਮ ਵਿਖੇ ਜਾ ਕੇ ਕਾਫੀ ਮਾਣ ਮਹਿਸੂਸ ਹੋਇਆ